ਅਲੱਗ ਅਲੱਗ ਪੰਛੀਆਂ ਨੂੰ ਅਲੱਗ ਅਲੱਗ ਚੀਜ਼ ਖਾਂਦੇ ਦੇਖਿਆ ਹੈ ਜੋ ਗਿੱਧ ਹੁੰਦੇ ਉਹ ਗਲਿਆ ਸੜਿਆ ਮਾਸ ਖਾਂਦੇ ਆ ਕਾਂ ਹੋ ਗਿਆ ਬਾਜ ਹੋ ਗਿਆ ਇਹ ਗਲਿਆ ਸੜਿਆ ਮਾਸ ਵੀ ਖਾ ਜਾਂਦੇ ਹਨ ਅਤੇ ਅਨਾਜ ਵੀ ਖਾ ਜਾਂਦੇ ਹਨ ਬਾਕੀ ਚਿੜੀਆਂ ਕਬੂਤਰ ਅਤੇ ਤੋਤੇ ਇਹ ਜ਼ਿਆਦਾਤਰ ਅਨਾਜ ਹੀ ਖਾਂਦੇ ਹਨ ਬਾਕੀ ਗਊਸ਼ਾਲਾ ਜਾ ਕੇ ਸਾਡੇ ਜੋ ਲੁਧਿਆਣੇ ਦੇ ਵਿੱਚ ਗਊਸ਼ਾਲਾ ਉੱਥੇ ਜਾ ਕੇ ਮੈਂ ਇਹਨਾਂ ਨੂੰ ਆਪਣੇ ਹੱਥੀਂ ਇਹਨਾਂ ਨੂੰ ਫੀਡ ਕਰਕੇ ਆਉਂਦਾ ਹਾਂ ਅਤੇ ਇਹਨਾਂ ਲਈ ਪਾਣੀ ਦਾ ਵੀ ਪ੍ਰਬੰਧ ਕਰਕੇ ਵੀ ਆਉਂਦਾ ਬੜਾ ਹੀ ਮਨ ਡ ਔਰ ਆਤਮਾ ਨੂੰ ਸਕੂਨ ਮਿਲਦਾ